ਸਕੂਲਾਂ ਦੀ ਫੀਸ ਬਾਰੇ ਥੋੜ੍ਹਾ ਜਿਹਾ ਦੱਸਿਆ ਚਾਹੁੰਦੇ ਹਾਂ ਫੀਸ ਜਿਹੜੀ ਸਕੂਲਾਂ ਵਿੱਚ ਲਈ ਜਾਂਦੀ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਨੇ ਪਾਰਟਸ ਕੀਤੇ ਹੋਏ ਹੋਏ ਹਨ ਜਿਵੇਂ ਕਿ ਪਹਿਲਾਂ ਐਡਮਿਸ਼ਨ ਫੀਸ ਲੈਂਦੇ ਹਨ ਜਦੋਂ ਦਾਖਲਾ ਫੀਸ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਦਾਖਲਾ ਫੀਸ ਲੈਣ ਤੋਂ ਬਾਅਦ ਫਿਰ ਇਹ ਟਰਾਂਸਪੋਰਟੇਸ਼ਨ ਫੀਸ ਲੈਂਦੇ ਆ ਬੱਸਾਂ ਦੀ ਫੀਸ ਲੈਂਦੇ ਹਨ ਫਿਰ ਇਹ ਕੰਪਿਊਟਰ ਫੀਸ ਲੈਂਦੇ ਹਨ ਲਾਈਬ੍ਰੇਰੀ ਫੀਸ ਲੈਂਦੇ ਹਨ ਅਤੇ ਉਸ ਤੋਂ ਬਾਅਦ ਇਹ ਟਿਊਸ਼ਨ ਫੀਸ ਵੀ ਲੈਂਦੇ ਹਨ ਅਤੇ ਜਦ ਕਈ ਸਕੂਲਾਂ ਵਿੱਚ ਤਾਂ ਜਨਰੇਟਰ ਫੀਸ ਵੀ ਬੱਚਿਆਂ ਤੋਂ ਲਈ ਜਾਂਦੀ ਹੈ ਇਹ ਫੀਸ ਸਾਰਿਆਂ ਦਾ ਇਕੱਠਾ ਕਰਕੇ ਇੱਕ ਇੱਕ ਫੀਸ ਦੇ ਰੂਪ ਵਿੱਚ ਟੋਟਲ ਫੀਸ ਜਿਹਨੂੰ ਅਸੀਂ ਲਿਖਿਆ ਹੁੰਦਾ ਉਹਦੇ ਵਿੱਚ ਇਹ ਅਦਾ ਕਰਨ ਨੂੰ ਸਾਨੂੰ ਕਹਿੰਦੇ ਹਨ ਅਤੇ ਇਹ ਵੈਸੇ ਇਹ ਜਿਹੜਾ ਸਕੂਲ ਦਾ ਜਿਹੜਾ ਫੀਸ ਦਾ ਢਾਂਚਾ ਹੈ ਇਹ ਬਹੁਤ ਹੀ ਖਰਾਬ ਹੈ ਖਾਸ ਕਰ ਜਿਹੜੇ ਪ੍ਰਾਈਵੇਟ ਸਕੂਲ ਹਨ ਉਹ ਇਹਨਾਂ 'ਤੇ ਕੋਈ ਲਗਾਮ ਨਹੀਂ ਹੈ ਸਰਕਾਰਾਂ ਦੀ ਸਰਕਾਰਾਂ ਨੂੰ ਚਾਹੀਦਾ ਹੈ ਵੀ ਇਹਨਾਂ 'ਤੇ ਲਗਾਮ ਲਗਾਈ ਜਾਵੇ ਅਤੇ ਫੀਸ ਦੇ ਢਾਂਚੇ ਨੂੰ ਦਰੁਸਤ ਕੀਤਾ ਜਾਵੇ ਸਰਕਾਰੀ ਸਕੂਲ 'ਚ ਤਾਂ ਨਹੀਂ ਸਰਕਾਰੀ ਸਕੂਲ 'ਚ ਤਾਂ ਸਗੋਂ ਇਹ ਸਹੂਲਤ ਹੈ ਵੀ ਸਾਰੇ ਬੱਚੇ ਬਹੁਤ ਹੀ ਘੱਟ ਫੀਸਾਂ ਦੇ ਵਿੱਚ ਤੁਸੀਂ ਸਰਕਾਰੀ ਜਿਹੜੀ ਹੈ ਐਜੂਕੇਸ਼ਨ ਉਹ ਤੁਸੀਂ ਪ੍ਰਾਪਤ ਕਰ ਸਕਦੇ ਹੋ ਪਰ ਪ੍ਰਾਈਵੇਟ ਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ ਤਾਂ ਉਹ ਮੋਟੀ ਫੀਸਾਂ ਇਹਨਾਂ ਦੇ ਪਹਿਲਾਂ ਅਲੱਗ ਅਲੱਗ ਇਸੇ ਕਰਕੇ ਫਿਰ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਕਰਕੇ ਜਦੋਂ ਟੋਟਲ ਫੀਸ ਅਸੀਂ ਦੇਖਦੇ ਹਾਂ ਤਾਂ ਬਹੁਤ ਵੱਡਾ ਇੱਕ ਅੰਕੜਾ ਬਣ ਜਾਂਦਾ ਹੈ ਜਿਹੜਾ ਕਿ ਬੱਚਿਆਂ ਦੇ ਮਾਪਿਆਂ ਨੂੰ ਦੇਖ ਕੇ ਬੜਾ ਹੀ ਦੁੱਖ ਮਹਿਸੂਸ ਹੁੰਦਾ ਹੈ ਵੀ ਇੰਨੀ ਫੀਸਾਂ ਅਸੀਂ ਕਿਦਾਂ ਪ੍ਰੋਵਾਈਡ ਕਰ ਸਕਦੇ ਹਾਂ ਤਾਂ ਕਿ ਹੋਰ ਖਰਚੇ ਵੀ ਜਿਹੜੇ ਨੇ ਉਹ ਵੀ ਅਸੀਂ ਚਲਾਉਣੇ ਹੁੰਦੇ ਤਾਂ ਕਿ ਪ੍ਰਾਈਵੇਟ ਸਕੂਲਾਂ ਨੂੰ ਚਾਹੀਦਾ ਹੈ ਵੀ ਆਪਣੇ ਫੀਸ ਦੇ ਜਿਹੜੇ ਪਾਰਟਸ ਨੇ ਉਹ ਨਾ ਜ਼ਿਆਦਾ ਵਧਾਏ ਜਾਣ ਇੱਕੋ ਹੀ ਇੱਕ ਜਾਂ ਦੋ ਪਾਰਟ ਹੀ ਰੱਖੇ ਜਾਣ ਅਤੇ ਉਹ ਵੀ ਮਾਤਰਾ ਸਾਰੇ ਮਾਪਿਆਂ ਦੇ ਅਪਰੋਚ ਵਿੱਚ ਹੋਵੇ ਤਾਂ ਹੀ ਇਹ ਅੱਗੇ ਕਾਮਯਾਬ ਹੋ ਸਕਦਾ ਹੈ